ਸਾਡੇ ਕੋਲ ਸਿਹਤ ਸੰਭਾਲ ਬੀਮਾ ਕਾਰਡ ਬਣਿਆ ਹੋਇਆ ਹੈ ਜਿਸ ਉੱਤੇ ਬਹੁਤ ਸਾਰੇ ਲਾਭ ਹਨ ਇਹ ਕਾਰਡ ਕਿਸਾਨਾਂ ਦਾ ਜੇ ਫਾਰਮ 'ਤੇ ਬਣਦਾ ਹੈ ਅਤੇ ਗਰੀਬ ਜਨਤਾ ਦਾ ਨੀਲੇ ਕਾਰਡ 'ਤੇ ਬਣਦਾ ਹੈ ਜਿਸ 'ਤੇ ਅਸੀਂ ਪੰਜ ਲੱਖ ਦਾ ਇਲਾਜ ਫਰੀ ਕਰਾ ਸਕਦੇ ਹਾਂ ਇਸ ਦੇ ਸਾਨੂੰ ਬਹੁਤ ਸਾਰੇ ਲਾਭ ਮਿਲਦੇ ਹਨ ਅਤੇ ਅਸੀਂ ਕਿਸੇ ਵੀ ਇਹ ਕਾਰਡ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਲਿਜਾ ਕੇ ਆਪਣਾ ਇਲਾਜ ਫਰੀ ਵਿੱਚ ਕਰਵਾ ਸਕਦੇ ਹਾਂ ਇਸ ਕਾਰਡ ਨਾਲ ਸਾਡਾ ਇੱਕ ਪੈਸਾ ਵੀ ਖਰਚਾ ਨਹੀਂ ਆਉਂਦਾ ਅਸੀਂ ਆਪਣੇ ਪੰਜ ਮੈਂਬਰਾਂ ਦਾ ਇਲਾਜ ਇਸ ਕਾਰਡ 'ਤੇ ਕਰਵਾ ਸਕਦੇ ਹਾਂ ਸਾਡੇ ਬਜ਼ੁਰਗਾਂ ਦੇ ਗੋਡੇ ਖਰਾਬ ਹੋਣ ਕਾਰਨ ਅਸੀਂ ਉਹਨਾਂ ਦਾ ਇਲਾਜ ਨਹੀਂ ਕਰਾ ਸਕਦੇ ਸੀ ਪਰ ਸਾਡੇ ਕੋਲ ਕਾਰਡ ਹੋਣ ਕਰਕੇ ਅਸੀਂ ਆਪਣੇ ਬਜ਼ੁਰਗਾਂ ਦੇ ਗੋਡੇ ਇਸ ਕਾਰਡ 'ਤੇ ਪੁਆਏ ਹਨ ਜੋ ਕਿ ਬਹੁਤ ਵਧੀਆ ਹਨ ਅਤੇ ਹੁਣ ਤੁਰ ਫਿਰ ਸਕਦੇ ਹਨ